ਹਾਂ ਅਸੀਂ ਪੇਂਟਿੰਗ ਹੱਥ ਨਾਲ ਬਣੇ ਕਾਰਡ ਤੋਹਫੇ ਆਪਣੇ ਟੀਚਰ ਨੂੰ ਆਪਣੇ ਅਧਿਆਪਕ ਆਪਣੇ ਮਾਤਾ ਪਿਤਾ ਆਪਣੇ ਇੱਕ ਛੋਟੇ ਭੈਣ ਭਰਾਵਾਂ ਨੂੰ ਦਿੱਤਾ ਕਿਉਂਕਿ ਉਹਨਾਂ ਨੂੰ ਬਣਾਉਣ ਹੱਥ ਨਾਲ ਬਣਾਉਣ ਨਾਲ ਸਾਡਾ ਉਸਦਾ ਮੁੱਲ ਹੋਰ ਵੀ ਵੱਧ ਜਾਂਦਾ ਹੈ